ਕੁਝ ਲੋਕ ਰਾਜਨੀਤਿਕ ਤਣਾਅ ਪੈਦਾ ਕਰਨ ਲਈ ਧਰਮ ਦਾ ਫਾਇਦਾ ਉਠਾਉਂਦੇ ਹਨ ਕਿਵੇਂ ਕਿ ਕਈ ਸਟੇਟਾਂ ਵਿੱਚ ਦੇਖਿਆ ਕਿ ਧਰਮ ਦਾ ਫਾਇਦਾ ਉਠਾਇਆ ਜਾਂਦਾ ਹੈ ਲੋਕਾਂ ਨੂੰ ਧਰਮਾਂ ਵਿੱਚ ਬ ਲੜਾਇਆ ਜਾਂਦਾ ਹੈ ਕਿਉਂਕਿ ਇਸ ਵਿੱਚ ਲੋਕ ਰਾਜਨੀਤਿਕ ਲੋਕ ਕਾਫ਼ੀ ਫਾਇਦਾ ਚੱਕਦੇ ਹਨ ਅਤੇ ਆਪਣੀਆਂ ਵੋਟਾਂ ਲੈਣ ਵਾਸਤੇ ਧਰਮਾਂ ਧਰਮਾਂ ਦਾ ਨਾਂ ਲੈ ਕੇ ਆਪਸ ਵਿੱਚ ਲੜਾਉਂਦੀਆਂ ਹਨ ਜਿਵੇਂ ਕਿ ਬੰਗਾਲ ਵਿੱਚ ਕਾਫ਼ੀ ਦੰਗੇ ਹੋਏ ਸਨ ਕਿਉਂਕਿ ਧਰਮਾਂ ਵਿੱਚ ਲੋਕਾਂ ਲੜਾਇਆ ਸੀ ਯੂ ਪੀ ਵਿੱਚ ਕਾਫ਼ੀ ਧਰਮਾਂ ਪਿੱਛੇ ਯਾਨੀ ਕਿ ਲੜਾਈ ਹੁੰਦੀ ਹੈ ਇਸ ਕਰਕੇ ਲੋਕ ਜਿਹੜੇ ਰਾਜਨੀਤਿਕ ਲੋਕ ਹੁੰਦੇ ਹਨ ਬਹੁਤ ਜ਼ਿਆਦੇ ਫਾਇਦਾ ਚੱਕਦੇ ਹਨ ਧਰਮ ਦਾ ਨਾਂ ਲੈ ਕੇ ਅਤੇ ਇਹਨਾਂ ਨੂੰ ਸਾ ਇਹਨਾਂ ਤੋਂ ਸਾਨੂੰ ਸੰਚੇਤ ਰਹਿਣਾ ਚਾਹੀਦਾ ਹੈ